ਮੈਨੂੰ ਲਿਖਣ ਦਾ ਬੜਾ ਸ਼ੌਕ ਹੈ ਅਤੇ ਮੈਂ ਇਸ ਵਾਸਤੇ ਇੱਕ ਸਟੱਡੀ ਰੂਮ ਬਣਾਇਆ ਹੋਇਆ ਹੈ ਜਿੱਥੇ ਮੈਂ ਬੈਠ ਕੇ ਲਿਖਦਾ ਹਾਂ ਜਿਸ ਤਰ੍ਹਾਂ ਕਿ ਰਾਮ ਨੌਮੀ ਗੁਰਪੁਰਬ ਗੁਰੂਆਂ ਦੇ ਗੁਰਪੁਰਬ ਅਤੇ ਹੋਰ ਤਿਉਹਾਰ ਆਉਂਦੇ ਹਨ ਮੈਂ ਉਸ 'ਤੇ ਉਹਨਾਂ ਦੇ ਹਫ਼ਤਾ ਪਹਿਲਾਂ ਹੀ ਗੂਗਲ 'ਤੇ ਰਿਸ ਸਰਚ ਮਾਰ ਕੇ ਉੱਥੋਂ ਨੋਟ ਕਰਦਾ ਹਾਂ ਅਤੇ ਹੋਰ ਵੀ ਹਿਸਟਰੀ ਦੀਆਂ ਕਿਤਾਬਾਂ ਤੋਂ ਨੋਟ ਕਰਕੇ ਉਹਨਾਂ 'ਤੇ ਇੰਪੋਰਟੈਂਟ ਜਿਹੜੀਆਂ ਗੱਲਾਂ ਲਿਖਦਾ ਹਾਂ ਅਤੇ ਉਹ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਲੋ ਅਤੇ ਇੱਥੇ ਮੈਂ ਔਨਲਾਈਨ ਮੀਟਿੰਗ ਵੇਲੇ ਵੀ ਆਪਣਾ ਬੋਲਦਾ ਹਾਂ ਅਤੇ ਬ ਲੋਕ ਬੜਾ ਪਸੰਦ ਕਰਦੇ ਹਨ